ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਹਾਂਜੀ ਹਾਂਜੀ ਹਾਂ ਹਾਂਜੀ ਠੀਕ ਹੈ ਜੀ ਹੂੰ ਮੇਰੇ ਕੋਲ ਖੜੀ ਹੈ ਇਸ ਟਾਇਮ ਕਰੇਟਾ ਖੜੀ ਹੈ ਦੋ ਹਜ਼ਾਰ ਪੰਦਰਾਂ ਮੌਡਲ ਅਤੇ ਬਰੀਜ਼ਾ ਖੜੀ ਹੈ ਇਹ ਵੀ ਦੋ ਹਜ਼ਾਰ ਸੋਲ਼ਾਂ ਮੋਡਲ ਅਤੇ ਇੱਕ ਉਹ ਖੜੀ ਹੈ ਥਾਰ ਖੜੀ ਹੈ ਥਾਰ ਹਾਂਜੀ ਸਕੋਰਪੀਓ ਵੀ ਹੈ ਸਕੋਰਪੀਓ ਦੋ ਹਜ਼ਾਰ ਸਤਾਰਾਂ ਕੁ ਸਤਾਰਾਂ ਮੋਡਲ ਡੀਜਲ ਹੂੰ

ਬਲੈਕ ਹੈ ਜੀ ਸਕੋਰਪੀਓ ਸੈਕਿੰਡ ਔਨਰ ਹੈ ਹਾਂਜੀ ਬਿਲਕੁੱਲ ਗੱਡੀ ਐਂਨ ਸਾਫ਼ ਹੈ ਟਾਇਰ ਨਵੇਂ ਹੈ ਵਿੱਦ ਸਰਵਿਸ ਰਿਕਾਰਡ ਹੈ ਗੱਡੀ ਕੋਈ ਗੱਡੀ 'ਚੋ ਕੋਈ ਪ੍ਰੋਬਲਮ ਨਹੀਂ ਹੈ

ਹਾਂਜੀ ਮੈਂ ਕਰ ਦਵਾਂਗਾ ਸੈਂਡ ਕਰ ਦਵਾਂਗਾ ਤੁਹਾਨੂੰ ਠੀਕ ਹੈ ਜੀ ਠੀਕ ਹੈ ਠੀਕ ਹੈ ਠੀਕ ਹੈ ਜੀ ਓਕੇ